ਹੈਲੋ ਹਾਂਜੀ ਤੁਸੀਂ ਜੀ ਮਨਫਤਿਹ ਦੇ ਫਾਦਰ ਬੋਲ ਰਹੇ ਹੋ ਜੀ ਹਾਂਜੀ ਤ ਤੁਸੀਂ ਜੀ ਮ ਮ ਮਤਲਬ ਬੇਟੇ ਨੂੰ ਕਿਹੜੇ ਸਕੂਲ ਵਿੱਚ ਲਗਾਉਣਾ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਜੀ ਆਪਣਾ ਪ ਜੀ ਪੀ ਐੱਸ ਸਕੂਲ ਹੈ ਜੀ ਆਪਣਾ ਇਹਦੇ ਵਿੱਚ ਫਤਿਹਗੜ੍ਹ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੈਫਰਨ ਸਿਟੀ ਸਮਾਰਟ ਸਕੂਲ ਕੇਂਦਰੀ ਵਿਦਿਆਲਿਆ ਜੀਸਸ ਜ਼ੇਵਿਅਰ ਡਿਵਾਈਨ ਲਾਈਟ ਪਬਲਿਕ ਸਕੂਲ ਚੰਡੀਗੜ੍ਹ ਪਬਲਿਕ ਸਕੂਲ ਗਰੀਨਫੀਲਡ ਓਕਰੇਜ ਮੈਂ ਆਪਣੀ ਬੇਟੀ ਨੂੰ ਜੀ ਕੇ ਵੀ ਦੇ ਵਿੱਚ ਲਗਾਇਆ ਹੋਇਆ ਹੈ ਕੇਂਦਰੀ ਵਿਦਿਆਲਿਆ ਦੇ ਵਿੱਚ ਉਹ ਦੇਖੋ ਜੀ ਆਪਣੇ ਮਤਲਬ ਇੱਕ ਤਾਂ ਦੇਖੋ ਸੈਂਟਰ ਲੈਵਲ ਦਾ ਸਕੂਲ ਹੈਗਾ ਔਰ ਵ ਸਭ ਤੋਂ ਵੱਡੀ ਗੱਲ ਹੈ ਕਿ ਉਹਦੀ ਜਿਹੜੀ ਦੇਖੋ ਫੀਸ ਹੈਗੀ ਮਤਲਬ ਬਾਕੀ ਸਕੂਲ ਦੇ ਕੰਪੈਰਟਿਵਲੀ ਵੀ ਮਤਲਬ ਅ ਆਪਣੀ ਉਹਦੇ ਵਿੱਚ ਆਉਂਦੀ ਕਿ ਆਮ ਆਦਮੀ ਉਹਨੂੰ ਪੇ ਕਰ ਸਕਦਾ ਹੈਗਾ ਔਰ ਉਹ ਸਭ ਤੋਂ ਵੱਡੀ ਗੱਲ ਹੈ ਸੈਂਟਰ ਲੈਵਲ ਦਾ ਐਜੂਕੇਸ਼ਨ ਵਾਈਜ ਸਟਾਫ ਵਾਈਜ ਉਹਦਾ ਐਟਮੋਸਫੀਅਰ ਉਹਦਾ ਇਨਵਾਇਰਮੈਂਟ ਮਤਲਵ ਹਰ ਇੱਕ ਚੀਜ਼ ਅ ਉਹ ਹੈਗੀ ਸੈਂਟਰ ਲੈਵਲ ਦੀ ਹੈਗੀ ਅਤੇ ਬੱਚੇ ਨੂੰ ਹਰ ਜਿਹੜੀ ਉਹਦੀ ਮਤਲਵ ਪੜ੍ਹਾਈ ਦੇ ਲੈਵਲ 'ਤੇ ਅਗਰ ਆਪਾਂ ਦੇਖੀਏ ਤਾਂ ਮੇਰੀ ਬੇਟੀ ਦੀ ਫਰੈਂਡ ਹੈਗੀ ਉਹ ਵੀ ਉੱਥੇ ਪੜ੍ਹਦੀ ਸੀਗੀ ਤਾਂ ਇਸ ਕਰਕੇ ਮੈਂ ਉਹਨੂੰ ਕੇ ਵੀ ਦੇ ਵਿੱਚ ਪਾਇਆ ਹੈਗਾ

ਸਕੂਲ ਦਾ ਮੀਡੀਅਮ ਦੋਨੋਂ ਲੈਂਗੁਏਜ ਬੱਚਾ ਯੂ ਇੱਥੇ ਲੈ ਸਕਦਾ ਅਤੇ ਉਹਨਾਂ ਕੋਲ ਇੰਗਲਿਸ਼ ਵੀ ਹੈਗੀ ਆ ਔਰ ਪੰਜਾਬੀ ਲੈਂਗੁਏਜ ਵੀ ਬੱਚਾ ਚੂਜ਼ ਕਰ ਸਕਦਾ ਹੈਗਾ ਉੱਥੇ ਓਪਸ਼ਨ ਹੈਗੀ ਆ ਮਤਲਵ ਬੱਚੇ ਨੂੰ ਦ ਮਤਲਵ ਆ ਜਿਵੇਂ ਆਪਾਂ ਕਹਿੰਦੇ ਆ ਕਿ ਆਮ ਆਮ ਭਾਸ਼ਾ ਵਿੱਚ ਕਿ ਬੱਚਾ ਕੋਈ ਵੀ ਭਾਸ਼ਾ ਰੱਖ ਸਕਦਾ ਪੰਜਾਬੀ ਅਗਰ ਉਹਨੂੰ ਸੌਖੀ ਲੱਗਦੀ ਤਾਂ ਉਹ ਪੰਜਾਬੀ ਭਾਸ਼ਾ ਵਿੱਚ ਵੀ ਰੱਖ ਲੈ ਸਕਦਾ ਆਪਣੀਆਂ ਕਿਤਾਬਾਂ ਦੀ ਜਿਹੜੀ ਲੈਣੀਆਂ ਹੁੰਦੀਆਂ ਨੇ ਪਲੱਸ ਵਨ ਪਲੱਸ ਟੂ ਜੋ ਜੋ ਉਹਦੇ ਬੁੱਕਸ ਨੇ ਗੇ ਬੱਚੇ ਦੀਆਂ ਐਂਡ ਜਿਹੜੇ ਆਪਾਂ ਕਹਿੰਦੇ ਆਗੇ ਕਿ ਭਾਸ਼ਾ ਦਾ ਜੇ ਚੂ ਚੈਨ ਕਰਨਾ ਹੈ ਬੱਚੇ ਨੇ ਉਹ ਦੋਨਾਂ ਭਾਸ਼ਾ ਵਿੱਚ ਹੈਗਾ ਗਾ ਇੰਗਲਿਸ਼ ਵੀ ਹੈ ਅਤੇ ਪੰਜਾਬੀ ਵੀ ਹੈ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਕਿਉਂਕਿ ਦੇਖੋ ਜਿਹੜਾ ਓਕਰਿਜ਼ ਸਕੂਲ ਹੈਗਾ ਉਹ ਵੈਸੇ ਸਭ ਤੋਂ ਬੈਸਟ ਸਕੂਲ ਮੰਨਿਆ ਜਾਂਦਾ ਹੈਗਾ ਬਿਕੋਸ ਜਿਹੜਾ ਉਹਦਾ ਐਟਮੋਸਫੀਅਰ ਆ ਉਹ ਬਹੁਤ ਵਧੀਆ ਹੈਗਾ ਇੰਨਫਰਾਸਟਕਚਰ ਬਹੁਤ ਵਧੀਆ ਹੈਗਾ ਬਟ ਉਹ ਕੋਸਟਲੀ ਬਹੁਤ ਜ਼ਿਆਦਾ ਉਹਦੀ ਫੀਸ ਬਹੁਤ ਜ਼ਿਆਦਾ ਹੈਗੀ ਔਰ ਆਮ ਆਦਮੀ ਆਪਣੀ ਆਮ ਭਾਸ਼ਾ ਦੇ ਵਿੱਚ ਅਗਰ ਆਪਾਂ ਕਹੀਏ ਉਹਦੀ ਫੀਸ ਬਹੁਤ ਜ਼ਿਆਦਾ ਹੈਗੀ ਉਸ ਹਿਸਾਬ ਨਾਲ ਜੋ ਕੇ ਵੀ ਸਕੂਲ ਕੇਂਦਰੀ ਵਿਦਿਆਲਿਆ ਹੈਗਾ ਉਹਦੀ ਆਮ ਆਦਮੀ ਦੀ ਪਹੁੰਚ ਦੇ ਵਿੱਚ ਹੈਗਾ ਤਾਂ ਇਸ ਕਰਕੇ ਹੈ ਜੋ ਇਹਦੀ ਫੀਸ ਜੀ ਸੌਲਾਂ ਸੌ ਰੁਪਏ ਹੈ ਜੀ ਤਿੰਨ ਮਹੀਨਿਆਂ ਦੇ ਬੱਚੇ ਦੀ ਹਾਂਜੀ ਹਾਂਜੀ ਇਹਦੀ ਲੋਕੇਸ਼ਨ ਜੀ ਆਪਾਂ ਨੂੰ ਅਗਰ ਆਪਾਂ ਔਨਲਾਈਨ ਸਰਚ ਕਰੀਏ ਤਾਂ ਆਪਾਂ ਨੂੰ ਅਵੇਲੇਬਲ ਹੋ ਜਾਂਦੀ ਹੈ ਬਹੁਤ ਇਜੀਲੀ ਇਹਦੇ ਵੈਬਸਾਈਟਸ ਵੀ ਅਵੇਲੇਬਲ ਨੇਗੀਆਂ ਕੰਪਿਊਟਰ ਆਪਾਂ ਸਰਚ ਕਰੀਏ ਕੇਂਦਰੀ ਵਿਦਿਆਲਿਆ ਰਿਓਨਾ ਉੱਚਾ ਪਿੰਡ ਦਾ ਨਾਮ ਸਾਰਾ ਕੁਛ ਤੁਹਾਨੂੰ ਉਹਦੇ ਵਿੱਚ ਅਵੇਲੇਬਲ ਹੋ ਜੇਗਾ ਔਰ ਸਾਈਟ ਦੇ ਉੱਪਰ ਤੁਸੀਂ ਜਾਓ ਕੰਪਿਊਟਰ ਦੇ ਵਿੱਚ ਸਰਚ ਕਰੋ ਕੇਂਦਰੀ ਵਿਦਿਆਲਿਆ ਰਿਓਨਾ ਉੱਚਾ ਫਤਿਹਗੜ੍ਹ ਸਾਹਿਬ ਅਤੇ ਉਹਦੀ ਸਾਈਟ ਬਣੀ ਹੋਈ ਐ ਪ੍ਰੋਪਰ ਹਰ ਚੀਜ਼ ਦੀ ਅ ਉਹਦੇ ਵਿੱਚ ਅ ਇੰ ਇੰਟਰਨੈਟ ਦੇ ਵਿੱਚ ਵੀ ਅਵੇਲੇਬਲ ਹੈ ਹਾਂਜੀ ਇਹਨਾਂ ਦੀਆਂ ਬੱਸਾਂ ਅਵੇਲੇਬਲ ਨੇ ਸਰ ਅਤੇ ਆਪਾਂ ਨੂੰ ਈਜ਼ੀਲੀ ਬੱਚਾ ਆਪਣਾ ਬੱਚਾ ਕਾਲਜ ਦੇ ਵਿੱਚ ਹੀ ਲੈ ਕੇ ਜਾਣਗੇ ਕਾਲਜ ਵਿੱਚ ਛੱਡ ਕੇ ਜਾਣਗੇ ਉਹਨਾਂ ਦੀਆਂ ਚਾਰਜਿਸ ਹੈ ਵੰਨ ਥਾਊਜੈਂਸ ਪਰ ਮੰਨਥ ਹੈ ਜੀ ਇਹਦੀ ਅਤੇ ਬੱਚੇ ਲਈ ਬੱਸਿਸ ਆਉਂਦੀਆਂ ਨੇ ਬੱਸਿਸ ਲੈ ਕੇ ਜਾਂਦੀਆਂ ਨੇ ਹੈਲੋ ਹਾਂਜੀ ਸਾਰੀਆਂ ਹਰ ਇੱਕ ਚੀਜ਼ ਮੈਂ ਤੁਹਾਨੂੰ ਦੱਸਦੀ ਹਾਂ ਹਰ ਇੱਕ ਚੀਜ਼ ਸੈਂਟਰ ਲੈਵਲ ਦੀ ਹੈ ਜੀ ਉਹ ਕਰੀਕੁਲਰ ਐਕਟੀਵਿਟੀਜ਼ ਬੱਚੇ ਨੂੰ ਮਤਲਬ ਕੋਈ ਫੰਕਸ਼ਨਜ਼ ਦੇ ਵਿੱਚ ਬੱਚੇ ਨੇ ਅਗਰ ਪਾਰਟੀਸਪੇਟ ਕਰਨਾ ਸਪੋਰਟ ਐਕਟੀਵਿਟੀ ਤਾਂ ਹਰ ਚੀਜ਼ ਸੈਂਟਰ ਲੈਵਲ ਦੀ ਹੈ ਬੱਚੇ ਨੂੰ ਹਰ ਚੀਜ਼ ਦਾ ਪ੍ਰੋਪਰ ਸਰਟੀਫਿਕੇਟ ਮਿਲਦਾ ਇਹਦੇ ਵਿੱਚ ਅਗਰ ਬੱਚਾ ਭਾਗ ਲੈਂਦਾ ਹੈਗਾ ਤਾਂ ਉਹਨੂੰ ਪ੍ਰੋਪਰ ਬੱਚੇ ਨੂੰ ਉਹਦਾ ਸਰਟੀਫਿਕੇਟ ਮਿਲੇਗਾ ਤਾਂ ਇਸ ਕਰਕੇ ਮੈਂ ਆਪਣੀ ਬੇਟੀ ਨੂੰ ਮਤਲਬ ਕੇਂਦਰੀ ਵਿਦਿਆਲਿਆ ਦੇ ਵਿੱਚ ਪਾਇਆ ਜੀ ਓਕੇ ਜੀ ਓਕੇ ਸਰ